ਭੰਗੜਾ ਐਰੋਬਿਕਸ ਵਿੱਚ ਸੰਗੀਤ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਹ ਸਿਰਫ ਐਕਸਰਸਾਈਜ਼ ਨੂੰ ਮਜ਼ੇਦਾਰ ਅਤੇ ਮਨੋਰੰਜਕ ਬਣਾਉਂਦਾ ਹੈ ਸਗੋਂ ਇਸ ਨਾਲ ਭੰਗੜਾ ਡ ਡਾਂਸ ਦੀ ਰੀਤ ਨੂੰ ਜ਼ਿਆਦਾ ਅਦਾਇਗੀ ਅਤੇ ਉਤਸ਼ਾਹ ਪੂਰਨ ਬਣਾਇਆ ਜਾ ਸਕਦਾ ਹੈ ਮਾਨਸਿਕ ਉਤਸ਼ਾਹ ਅਤੇ ਖੁਸ਼ੀ ਸੰਗੀਤ ਮਨੁੱਖੀ ਮੂਲ ਨੂੰ ਪ੍ਰਭਾਵਿਤ ਕਰਨ ਦੀ ਕਾਬਲੀਅਤ ਰੱਖਦਾ ਹੈ ਜਦੋਂ ਭੰਗੜਾ ਐਰੋਬਿਕਸ ਵਿੱਚ ਤੇਜ਼ ਅਤੇ ਤਾਲ ਤਾਲ ਭਰਪੂਰ ਗਾਣੇ ਚੱਲ ਰਹੇ ਹੁੰਦੇ ਹਨ ਤਾਂ ਇਸ ਨਾਲ ਸਰੀਰ ਵਿੱਚ ਤਾਜ਼ਗੀ ਅਤੇ ਉਤਸ਼ਾਹ ਆਉਂਦਾ ਹੈ ਭੰਗੜਾ ਦੇ ਰੀਤਮਿਕ ਬੀਟਸ ਸਰੀਰ ਨੂੰ ਗਤੀ ਮਿਲਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਵਿਯਆਮ ਹੋਰ ਦਿਲਚਸਪ ਬਣਾਇਆ ਜਾ ਸਕਦਾ ਹੈ ਗਤੀ ਅਤੇ ਹਲਚਲ ਨਾਲ ਮਿਲਾਪ ਭੰਗੜਾ ਐਰੋਬਿਕਸ ਵਿੱਚ ਗਾਣੇ ਸੰਗੀਤ ਦੇ ਬੀਟ ਸਿਰਫ ਕਸਰਤ ਦੇ ਰੀਤਮ ਨੂੰ ਨਿਰਧਾਰਿਤ ਨਹੀਂ ਕਰਦੇ ਬਲਕਿ ਉਹ ਸਰੀਰ ਦੇ ਮੂਵਮੈਂਟਸ ਨੂੰ ਵੀ ਅਨੁਕੂਲ ਬਣਾਉਂਦੇ ਹਨ ਸੰਗੀਤ ਦੇ ਮੂੜ ਨਾਲ ਖਿੱਚਤੀਆਂ ਮੋੜਾਂ ਅਤੇ ਮੂਵਮੈਂਟ ਦੇ ਸੰਕਲਨ ਨੂੰ ਜ਼ਿਆਦਾ ਫਲਦਾਇਕ ਬਣਾਇਆ ਜਾ ਸਕਦਾ ਹੈ ਸੰਗੀਤ ਦਾ ਐਨਰਜੀ ਦੇ ਪ੍ਰਭਾਵ ਜਿਵੇਂ ਕਿ ਭੰਗੜਾ ਇੱਕ ਤੇਜ਼ ਅਤੇ ਉਤਸ਼ਾਹ ਪੂਰਨ ਡਾਂਸ ਹੈ ਇਸ ਵਿੱਚ ਆਮ ਤੌਰ 'ਤੇ ਉੱਚੀ ਤਾਲ ਵਾਲੇ ਗਾਣੇ ਅਤੇ ਧੁਨੀਆਂ ਵਰਤੀਆਂ ਜਾਂਦੀਆਂ ਹਨ ਗਾਣੇ ਜਿਵੇਂ ਕਿ ਮੂਹਾਂ ਭੰਗੜਾ ਲਹਿੰਗਾ ਅਤੇ ਹੋਰ ਭੰਗੜਾ ਸਟਾਈਲ ਦੇ ਗਾਣੇ ਭੰਗੜਾ ਐਰੋਬਿਕਸ ਵਿੱਚ ਬਹੁਤ ਮਸ਼ਹੂਰ ਹਨ ਇਹ ਗਾਣੇ ਸਰੀਰ ਨੂੰ ਜ਼ਿਆਦਾ ਐਨਰਜੀ ਦੇਣ ਵਿੱਚ ਮਦਦ ਕਰਦੇ ਹਨ ਅਤੇ ਵਰਕਆਊਟ ਦੌਰਾਨ ਥਕਾਵਟ ਨੂੰ ਘਟਾਉਂਦੇ ਹਨ ਮੂਡ ਅਤੇ ਮਾਨਸਿਕ ਤਾਜ਼ਗੀ ਭੰਗੜਾ ਐਰੋਬਿਕਸ ਵਿੱਚ ਵਰਤੇ ਜਾਣ ਵਾਲੇ ਗਾਣੇ ਮਾਨਸਿਕ ਤਾਜ਼ਗੀ ਅਤੇ ਖੁਸ਼ੀ ਦਾ ਸੂਤਰ ਹੁੰਦੇ ਹਨ ਜਿਵੇਂ ਹੀ ਸੰਗੀਤ ਵਿੱਚ ਮਜ਼ੇਦਾਰ ਤਾਲ ਮਿਲਦੀ ਹੈ ਵਿਅਕਤੀ ਮਨੋਮਸਤੀ ਅਤੇ ਖੁਸ਼ੀ ਮਹਿਸੂਸ ਕਰਦਾ ਹੈ ਜੋ ਐਕਸਰਸਾਈਜ ਨੂੰ ਮਨਪਸੰਦ ਅਤੇ ਲੰਬੇ ਸਮੇਂ ਤੱਕ ਕਰਨ ਵਾਲਾ ਬਣਾਉਂਦਾ ਹੈ ਮਸ਼ਹੂਰ ਸੰਗੀਤ ਅਤੇ ਰੀਤਮਿਕ ਤਾਲ ਭੰਗੜਾ ਐਰੋਬਿਕਸ ਵਿੱਚ ਆਮ ਤੌਰ 'ਤੇ ਪੋਪ ਅਤੇ ਭੰਗੜਾ ਡਾਂਸ ਮਿਊਜਿਕ ਵਰਤੀ ਜਾਂਦੀ ਹੈ ਜਿਵੇਂ ਕਿ ਡੀ ਜੇ ਦਾ ਤਾਜ਼ਾ ਕੰਬੋ ਜਾਂ ਭੰਗੜਾ ਨਾਲ ਬਰਕਰੇ ਰਿਦਮ ਵਾਲੇ ਗਾਣੇ ਵਰਤੇ ਜਾਂਦੇ ਹਨ ਜੋ ਨੱਚਣ ਵਾਲੇ ਨੂੰ ਮੋਹਨ ਅਤੇ ਉਤਸ਼ਾਹਿਤ ਕਰਦੇ ਹਨ ਅੰਤ ਵਿੱਚ ਭੰਗੜਾ ਅਰੋਬਿਕਸ ਨੂੰ ਸੰਗੀਤ ਦੇ ਨਾਲ ਮਜ਼ੇਦਾਰ ਅਤੇ ਉਤਸ਼ਾਹ ਪੂਰਨ ਬਣਾਉਣਾ ਉੱਚਿਤ ਬਣਾਉਣ ਵਿੱਚ ਉੱਚੀ ਤਾਲ ਦੇ ਗਾਣੇ ਅਤੇ ਸਰੀਰ ਨੂੰ ਐਨਰਜੀ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦਾ ਹੈ